ਹੈਲੋ ਹੈਲੋ ਖੁਸ਼ਲੀਨ ਕੀ ਕਰਦੇ ਸੀ ਮੈਂ ਸਿਮਰਨ ਵਧੀਆ ਹੋਰ ਸੁਣਾਓ ਕੀ ਕਰਦੇ ਸੀ ਮੈਂ ਵੀ ਟੀ ਵੀ 'ਤੇ ਕਪਿਲ ਸ਼ਰਮਾ ਹੀ ਦੇਖ ਰਹੀ ਸੀ ਤੁਹਾਨੂੰ ਪਤਾ ਤਾਂ ਹੈ ਬਹੁਤ ਚੱਲ ਰਿਹਾ ਮਤਲਬ ਕਿੰਨੀ ਤਰੱਕੀ ਕੀਤੀ ਹੈ ਨਾ ਕਪਿਲ ਨੇ ਮੈਂ ਵੀ ਸੋਚ ਰਹੀ ਸੀਗੀ ਕਿ ਆਪਣੇ ਪੰਜਾਬ ਤੋਂ ਗਿਆ ਇਹ ਅੰਮ੍ਰਿਤਸਰ ਤੋਂ ਕਿੰਨੇ ਬੋਲੀਵੁੱਡ 'ਚ ਕਿੰਨੀ ਤਰੱਕੀ ਕੀਤੀ ਹੈ ਹੈ ਨਾ ਇਸਨੇ ਆਪਣੇ ਨਾਲ ਨਾਲ ਮਤਲਬ ਭਾਰਤੀ ਨੂੰ ਵੀ ਅੱਗੇ ਲੈ ਕੇ ਜਾਤਾ ਉਹਨੇ ਵੀ ਬਹੁਤ ਸਾਰੀ ਤਰੱਕੀਆਂ ਕੀਤੀਆਂ ਨੇਗੀਆਂ

ਉਹ ਵੀ ਆਪਣੇ ਪੰਜਾਬ ਤੋਂ ਅੰਮ੍ਰਿਤਸਰ ਤੋਂ ਹੀ ਨੇ ਭਾਰਤੀ ਜੀ ਹਾਂਜੀ ਅਤੇ ਆਪਣੇ ਹੋਰ ਕਿਵੇਂ ਸੰਨੀ ਦਿਓਲ ਹੋ ਗਿਆ ਨਾ ਅਤੇ ਆਪਣਾ ਦਿਲਜੀਤ ਵਗੈਰਾ ਨੇ ਕਿੰਨੀਆਂ ਮੂਵੀਜ਼ ਕੀਤੀਆਂ ਨੇ ਬੋਲੀਵੁੱਡ 'ਚ ਜਾ ਕੇ ਆਪਣਾ ਪੰਜਾਬ ਦਾ ਬਹੁਤ ਨਾਮ ਕੀਤਾ ਹੈ ਉਹਨਾਂ ਦੀ ਮਤਲਬ ਪਰ ਜਿਹੜੀ ਮੂਵੀ ਆਉਂਦੀਆਂ ਨੇ ਨਾ ਬੋਲੀਵੁੱਡ ਦੀਆਂ ਉੱਪਰ ਸੁਪਰ ਡਿਪ ਹਿੱਟ ਜਾਂਦੀਆਂ ਨੇ ਮਤਲਬ ਬਹੁਤ ਚੱਲਦੀਆਂ ਨੇ ਉਹਦੀਆਂ ਤਾਂ ਮੂਵੀਜ਼ ਬਹੁਤ ਨਾਮ ਬਣਾ ਲਿਆ ਉਹਨੇ ਆਪਣਾ ਬੱਚੇ ਬੱਚੇ ਮਤਲਬ ਮੈਂ ਕਹਿੰਦੀ ਹਾਂ ਬਹੁਤ ਫੈਨ ਬਣ ਚੁੱਕੇ ਨੇਗੇ ਸਾਰੇ ਬੋਲੀਵੁੱਡ ਵਾਲੇ ਵੀ ਸਾਰੇ ਅ ਦਲਜੀਤ ਨੂੰ ਇੰਨਾ ਪਸੰਦ ਕਰਦੇ ਨੇਗੇ ਬਹੁਤ ਜ਼ਿਆਦਾ ਮਤ ਮਤ ਮਤਲਬ ਕਪਿਲ ਸ਼ਰਮਾ ਦੇ ਸ਼ੋਅ ਨੂੰ ਤਾਂ ਮੈਂ ਕਹਿੰਦੀ ਹਾਂ ਸਾਰਾ ਬੱਚਾ ਬੱਚਾ ਇੰਨਾ ਦੇਖਦਾ ਨਾ ਕੋਈ ਕਹਿ ਹੀ ਨਹੀਂ ਸਕਦਾ ਕਿ ਕਪਿਲ ਸ਼ਰਮਾ ਪੰਜਾਬ ਤੋਂ ਗਿਆ ਉੱਥੇ ਜਾ ਕੇ ਇੰਨਾਂ ਰ ਰਲ ਮਿਲ ਗਿਆ ਨਾ ਲੱਗਦਾ ਹੀ ਨਹੀਂ ਕਿ ਪੰਜਾਬ ਤੋਂ ਗਿਆ ਪਰ ਉਸਨੇ ਪੰਜਾਬ ਦੀ ਬਹੁਤ ਬ ਤਰੱਕੀ ਕੀਤੀ ਆ ਉੱਥੇ ਜਾ ਕੇ ਹਾਂਜੀ ਉਨ ਹਾਂਜੀ ਉਹਨੇ ਵੀ ਕਪਿਲ ਨਾਲ ਰਹਿ ਰਹਿ ਕੇ ਆਪਣਾ ਨਾਮ ਬਣਾ ਲਿਆ ਚਲੋ ਠੀਕ ਹੈ ਹੈਂ ਬਰੇ ਬਰੇਕ ਆਈ ਸੀ ਸ਼ੋਅ 'ਚ ਮੈਂ ਫਿਰ ਗੱਲ ਕਰਾਂਗੇ ਆਪਾਂ ਚਲੋ ਠੀਕ ਹੈ ਜੀ ਹਾਂਜੀ ਓਕੇ ਓਕੇ